ਪ੍ਰਾਰਥਨਾਵਾਂ ਅਤੇ ਉਪਾਸਨਾ ਬਾਰੇ ਸਾਡੇ ਵੱਡਿਆਂ ਨੇ ਸਾਨੂੰ ਬਹੁਤ ਹੀ ਮਤਲਬ ਬਹੁਤ ਕੁਛ ਸਿਖਾਇਆ ਹੋਇਆ ਅਤੇ ਬਹੁਤ ਹੀ ਚੰਗਾ ਅਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕੁਛ ਗਲਤ ਸਿਖਾਇਆ ਏ ਅਤੇ ਮੈਨੂੰ ਇਹਦੇ ਬਾਰੇ ਕੁਛ ਗਲਤ ਪਤਾ ਹੈ